ਕੀ ਪਹਾੜ ਦੀ ਚੜ੍ਹਾਈ ਜੀ ਪਹਾੜ ਦੀ ਚੜ੍ਹਾਈ ਵੇਲੇ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਖ਼ਾਸ ਧਿਆਨ ਜੇ ਅਸੀਂ ਆਪਣੇ ਵੱਲ ਤੋਂ ਪਹਾੜ ਦੀ ਚੜ੍ਹਾਈ ਜਿਵੇਂ ਕਿ ਆਪਣਾ ਮੰਦਰ ਹੈ ਜ਼ਿਆਦਾ ਕਰਕੇ ਇੱਥੇ ਮੰਦਿਰ ਪੰਜਾਬ ਦੇ ਉਚਾਈਆਂ 'ਤੇ ਹਨ ਜੇ ਅਸੀਂ ਪੰਜਾਬ ਦੇ ਮੰਦਰਾਂ ਨੂੰ ਜਾਂਦੇ ਹਨ ਆਪਣੇ ਵੱਲ ਤੋਂ ਤਾਂ ਕੋਈ ਵੀ ਅਜਿਹੀ ਕਾਰਵਾਈ ਨਹੀਂ ਹੈ ਕਿ ਆਪਣਾ ਆਧਾਰ ਕਾਰਡ ਜਾਂ ਕੁਛ ਵੀ ਆਪਣਾ ਨਜ਼ਦੀਕੀ ਪੁਲਿਸ ਚੌਂਕੀ ਵਿੱਚ ਦਾਖ਼ਲ ਕਰਵਾਇਆ ਜਾਵੇ ਅਤੇ ਲਿਖਤ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਇਹ ਹੀ ਗੱਲਾਂ ਦਾ ਲਿਖਤ ਜ਼ਿਕਰ ਕੀਤਾ ਜਾਂਦਾ ਜੀ ਅਸੀਂ ਰੋਕ ਕਲਾਈਮਿੰਗ ਜਿਵੇਂ ਕਿ ਇੱਥੇ ਕਰੀਏ ਤਾਂ ਉਹ ਸਾਡਾ ਆਧਾਰ ਕਾਰਡ ਜਾਂ ਸਾਡੇ ਪ੍ਰੂਫ ਲੈਂਦੇ ਹਨ ਅਤੇ ਉਹ ਕਹਿੰਦੇ ਹਨ ਕਿ ਤੁਸੀਂ ਆਪਣੀ ਜ਼ਿੰਮੇਵਾਰੀ 'ਤੇ ਕਰ ਰਹੇ ਹੋ ਉਸ ਵਿੱਚ ਸੇਫਟੀ ਦਾ ਪੂਰਾ ਧਿਆਨ ਕੀਤਾ ਜਾਂਦਾ ਹੈ ਕਿ ਇਹ ਸਭ ਨਾਲੋਂ ਤਾਂ ਜ਼ਰੂਰੀ ਕੰਮ ਹੈ ਕਿਉਂਕਿ ਇਹ ਇਹ ਖ਼ਤਰੇ ਵਾਲਾ ਕੰਮ ਹੈ ਤਾਂ ਇਹ 'ਚ ਮਤਲਬ ਕਿ ਆਪਣੀ ਸੇਫਟੀ ਪਹਿਲਾਂ ਹੈ ਅਤੇ ਚੜ੍ਹਾਈ ਬਾਅਦ ਵਿੱਚ